ਭਾਰਤ ਵਿੱਚ ਸਿੱਖਿਆ ਪ੍ਰਣਾਲੀ ਜੇ ਬਹੁਤ ਉੱਚ ਪੱਧਰ ਦੀ ਨਹੀਂ ਹੈਗੀ ਹੈ ਤਾਂ ਬਹੁਤ ਨੀਵੇਂ ਪੱਧਰ ਦੀ ਨਹੀਂ ਹੈ ਅਤੇ ਇਹ ਮੱਧਮ ਜਿਹੇ ਪੱਧਰ ਦੀ ਹੈ ਅਤੇ ਇਸਦੇ ਦੂਜੇ ਦੇਸ਼ਾਂ ਨ ਮ ਤੁਲਨਾ ਕਰੀਏ ਤਾਂ ਕਾਫੀ ਦੇਸ਼ਾਂ ਦੇ ਨਾਲੋਂ ਇਹ ਬਹੁਤ ਵਧੀਆ ਹੈ ਪਰ ਜੇ ਅਸੀਂ ਬਹੁਤ ਜ਼ਿਆਦਾ ਐਡਵਾਂਸ ਜਿਹੜੇ ਦੇਸ਼ ਹਨ ਜਿਹੜੇ ਤਰੱਕੀ ਕਰ ਰਹੇ ਹਨ ਉਹਨਾਂ ਪੱਛਮੀ ਦੇਸ਼ਾਂ ਨਾਲ ਅਸੀਂ ਇਹਨਾਂ ਦੀ ਤੁਲਨਾ ਕਰੀਏ ਤਾਂ ਸਾਡੀ ਜਿਹੜੀ ਸਿੱਖਿਆ ਪ੍ਰਣਾਲੀ ਹੈ ਉਹ ਬਹੁਤ ਜ਼ਿਆਦਾ ਕਮੀਆਂ ਨਾਲ ਭਰਪੂਰ ਹੈ ਕਿਉਂਕਿ ਉੱਥੇ ਜ਼ਿਆਦਾਤਰ ਬਾਹਰਲੇ ਦੇਸ਼ਾਂ ਵਿੱਚ ਆਧੁਨਿਕ ਦੇਸ਼ਾਂ ਵਿੱਚ ਵਿਕਸਿਤ ਦੇਸ਼ਾਂ ਦੇ ਵਿੱਚ ਜਿਹੜੇ ਬੱਚੇ ਹਨ ਉਹਨਾਂ ਨੂੰ ਪ੍ਰੈਕਟੀਕਲੀ ਪੜ੍ਹਾਈ 'ਤੇ ਜ਼ਿਆਦਾ ਜੋਰ ਦਿੱਤਾ ਜਾਂਦਾ ਹੈ ਅਤੇ ਉਹਨਾਂ ਨੂੰ ਸਿਲੇਬਸ ਵੀ ਜਿਹੜਾ ਹੈਗਾ ਆ ਉਹ ਬਿਲਕੁਲ ਫਰੈਸ਼ ਔਰ ਤੀਜੇ ਨੰਬਰ 'ਤੇ ਉਹਨਾਂ ਨੂੰ ਉਹ ਚੀਜ਼ਾਂ ਸਿਖਾਈਆਂ ਜਾਂਦੀਆਂ ਹਨ ਜਿਹੜੀਆਂ ਕਿ ਉਹ ਪੜ੍ਹਨ ਤੋਂ ਬਾਅਦ ਉਹਨਾਂ ਦੇ ਰੋਜ਼ੀ ਰੋਟੀ ਕਮਾਉਣ ਦੇ ਕੰਮ ਆ ਸਕਣ ਅਤੇ ਪਰ ਸਾਡੇ ਦੇਸ਼ ਦੀ ਸਿੱਖਿਆ ਪ੍ਰਣਾਲੀ ਦੇ ਵਿੱਚ ਇਹ ਬਹੁਤ ਜ਼ਿਆਦਾ ਵੱਡੀ ਕਮੀ ਹੈ ਕਿ ਅਸੀਂ ਬੱਚਿਆਂ ਨੂੰ ਪੁਰਾਣੇ ਹੀ ਸਿਲੇਬਸ 'ਤੇ ਜ਼ੋਰ ਦੇ ਰਹੇ ਹਾਂ ਅਤੇ ਉਹਨਾਂ ਨੂੰ ਤੋਤੇ ਵਾਂਗ ਜਿਹੜਾ ਹੈਗਾ ਉਹ ਰੱਟਾ ਮਰਵਾ ਰਹੇ ਹਾਂ ਅਸੀਂ ਇਹ ਨਹੀਂ ਸੋਚਦੇ ਕਿ ਅਸੀਂ ਇੱਦਾਂ ਦੇ ਇੱਕ ਆਧੁਨਿਕਤਾ ਲੈ ਕੇ ਆਈਏ ਜਿਹਦੇ ਵਿੱਚ ਕਿ ਜਿਹੜੇ ਬੱਚੇ ਹਨ ਉਹਨਾਂ ਨੂੰ ਇੱਕ ਤਾਂ ਜਿਹੜੀ ਉਹ ਪੜ੍ਹਾਈ ਕਰਾਈਏ ਜਿਹੜੀ ਕਿ ਉਹਨਾਂ ਨੂੰ ਬਾਅਦ ਵਿੱਚੋਂ ਕੰਮ ਕਾਰ ਕਰਕੇ ਉਹ ਆਪਣਾ ਪੇਟ ਭਰ ਸਕਣ ਆਪਣੇ ਔਰ ਆਪਣੇ ਪਰਿਵਾਰ ਦਾ ਦੂਜੇ ਨੰਬਰ 'ਤੇ ਜਿੱਦਾਂ ਕਿ ਆਧੁਨਿਕ ਦੇਸ਼ਾਂ ਦੇ ਵਿੱਚ ਉਹਨਾਂ ਨੂੰ ਗਰੁੱਪ ਬਣਾ ਕੇ ਇੱਕ ਉਹਨਾਂ ਨੂੰ ਸਿਖਾਇਆ ਜਾਂਦਾ ਹੈ ਤਾਂ ਕਿ ਜਿਹੜੀ ਜਾਣਕਾਰੀ ਹੈ ਜਿਹੜਾ ਗਿਆਨ ਹੈ ਉਸਦਾ ਅਦਾਨ ਪ੍ਰਦਾਨ ਹੋ ਸਕੇ ਜਿਹੜੇ ਨਲਾਇਕ ਹਨ ਉਹ ਹੁਸ਼ਿਆਰ ਬੱਚਿਆਂ ਤੋਂ ਸਿੱਖ ਸਕਣ ਤਾਂ ਕਿ ਜਿਤਨੀ ਕਲਾਸ ਆ ਉਹ ਸਾਰੇ ਹੀ ਇਸ ਚੀਜ਼ ਨੂੰ ਮਤਲਬ ਕਿ ਹੁਸ਼ਿਆਰ ਹੋ ਸਕਣ ਸੋ ਇੱਥੇ ਸਾਡੇ ਦੇਸ਼ ਵਿੱਚ ਇਸ ਚੀਜ਼ ਦੀ ਬਹੁਤ ਜ਼ਿਆਦਾ ਕਮੀ ਹੈ ਸੋ ਸਾਨੂੰ ਇਹਨਾਂ ਗੱਲਾਂ 'ਤੇ ਧਿਆਨ ਦੇਣਾ ਚਾਹੀਦਾ ਹੈ